ਅਸੀਂ ਆਮ ਤੌਰ 'ਤੇ ਸਮਾਂ ਬਚਾਉਣ ਅਤੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਰਸੋਈ ਸਾਂਝੀ ਕਰਦੇ ਹਾਂ ਜਿਸ ਕਰਕੇ ਅਸੀਂ ਕਈ ਵਾਰੀ ਜਿੱਦਾਂ ਕਿ ਕਦੀ ਕ ਵਾਰੀ ਮੰਮਾ ਅਤੇ ਮੈਂ ਆਪਾਂ ਦੋਵਾਂ ਨੇ ਰਲ ਮਿਲ ਕੇ ਖਾਣਾ ਬਣਾਉਣਾ ਹੁੰਦਾ ਹੈ ਅਤੇ ਉਦੋਂ ਕਈ ਵਾਰੀ ਮੰਮਾ ਰੋਟੀ ਬਣਾ ਦਿੰਦੇ ਹਨ ਅਤੇ ਮੈਂ ਸਬਜ਼ੀ ਬਣਾ ਲੈਂਦੀ ਹਾਂ ਅਤੇ ਉਸ ਜਦੋਂ ਆਪਾਂ ਇਹ ਕੰਮ ਕਰ ਰਹੇ ਹੁੰਦੇ ਹਾਂ ਨਾਲ ਨਾਲ ਆਪਾਂ ਗੱਲਾਂ ਵੀ ਮਾ ਗੱਲਾਂ ਵੀ ਕਰਦੇ ਹਾਂ ਅਤੇ ਇਸ ਨਾਲ ਸਾਡਾ ਕੰਮ ਛੇਤੀ ਵੀ ਹੁੰਦਾ ਹੈ ਸਹੀ ਤਰੀਕੇ ਨਾਲ ਵੀ ਹੁੰਦਾ ਕੋਈ ਥੱਕਦਾ ਵੀ ਨਹੀਂ ਅਤੇ ਜਿਹੜਾ ਕੰਮ ਆ ਉਹ ਫਟਾਫਟ ਹੋ ਜਾਂਦਾ ਇਹ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਉਸ ਵਿੱਚ ਸਾਨੂੰ ਦੋਹਾਂ ਨੂੰ ਟਾਈਮ ਵੀ ਮਿਲਦਾ ਇਕੱਠੇ ਰਲ ਮਿਲ ਕੇ ਕੰਮ ਕਰਨ ਦਾ ਅਤੇ ਗੱਲਾਂ ਕਰਨ ਦਾ ਨਾਲ ਨਾਲ ਅਤੇ ਇਸ ਤਰੀਕੇ ਨਾਲ ਮੈਨੂੰ ਬਹੁਤ ਮਜ਼ਾ ਆਉਂਦਾ ਹੈ